ਬਚਪਨ ਤੋਂ ਹੀ ਮੇਰੀ ਵੀਡੀਓ ਗੇਮ ਵਿੱਚ ਕਾਫੀ ਰੁਚੀ ਹੈ ਬਚਪਨ ਵਿੱਚ ਮੈਂ ਮਾਰੀਓ ਨਾਮ ਦੀ ਗੇਮ ਆਉਂਦੀ ਸੀਗੀ ਜੋ ਕਿ ਇੱਕ ਕੰਪਿਊਟਰ ਦੇ ਕੀਬੋਰਡ ਵਰਗੀ ਸੀਗੀ ਅਤੇ ਉਸ ਵਿੱਚ ਇੱਕ ਚਿਪ ਪੈਂਦੀ ਸੀ ਅਤੇ ਚਿਪ ਪਾ ਕੇ ਮੈਂ ਗੇਮਾਂ ਖੇਡਦਾ ਸੀਗਾ ਅਤੇ ਇੱਕ ਬੰਦੂਕ ਵਾਲ਼ੀ ਗੇਮ ਸੀਗੀ ਜਿਸ ਵਿੱਚ ਬੰਦੂਕ ਨਾਲ਼ ਮੈਂ ਗੋਲੀਆਂ ਚਲਾਉਣੀ ਸੀਗੀਆਂ ਹਨ ਅਤੇ ਹੁਣ ਜੋ ਜੋ ਜੋ ਟੈਕਨੀਕ ਟੈਕਨੀਕੀ ਵਧੀ ਗਈ ਉ ਉੱਦਾਂ ਹੀ ਵੀਡੀਓ ਗੇਮਾਂ ਵੀ ਵਧੀਆ ਆ ਰਹੀਆਂ ਹਨ ਹੁਣ ਮੈਂ ਕੰਪਿਊਟਰ ਵਿੱਚ ਵੀ ਵੀਡੀਓ ਗੇਮਾਂ ਖੇਡਦਾ ਹਨ ਅਤੇ ਮੇਰੇ ਕੋਲ ਇੱਕ ਪਲੇਅ ਸਟੇਸ਼ਨ ਵੀ ਹੈ